ਹਾਂਜੀ ਸੋ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੇਰਾ ਫਸਟ ਜਦੋਂ ਹਨੀਮੂਨ ਸੀ ਆਫਟਰ ਵੈਡਿੰਗ ਸੋ ਅਸੀਂ ਟੂਰ ਬਣਾਇਆ ਸੀ ਡਲਹੌਜ਼ੀ ਸੋ ਕਾਫੀ ਅੱਛੀ ਮੈਮੋਰੀ ਰਹੀ ਹੈ ਐਂਡ ਸੋ ਅਸੀਂ ਪਹਿਲਾਂ ਹੀ ਸਾਰਾ ਹੋਟਲ ਵਗੈਰਾ ਬੁੱਕ ਕਰਤੇ ਸੀ ਅਤੇ ਕਾਫੀ ਅਸੀਂ ਇੰਜੋਏ ਕੀਤਾ ਹੈ ਡਿਊਰਿੰਗ ਜਰਨੀ ਐਂਡ ਸੋ ਮੈਂ ਡਿਸਾਈਡ ਕੀਤਾ ਸੀ ਵੀ ਆਪਣੀ ਕਾਰ 'ਤੇ ਜਾਈਏ ਕਿਉਂ ਅਸੀਂ ਕੈਪਚਰ ਕਰ ਸਕੀਏ ਸੀਨਿਕ ਵਿਊ ਜਿਹੜੇ ਰਸਤੇ ਵਿੱਚ ਆਉਂਦੇ ਆ ਅਤੇ ਅਸੀਂ ਕਾਫੀ ਜਗ੍ਹਾ ਰੁਕੇ ਅਸੀਂ ਇੰਜੋਏ ਕੀਤਾ ਅਸੀਂ ਫੋਟੇ ਖਿੱਚੀਆਂ ਕਿਉਂ ਇੱਕ ਮੈਮੋਰੀ ਦੇ ਤੌਰ 'ਤੇ ਵੀ ਸਾਨੂੰ ਆਪਣਾ ਫਸਟ ਹਨੀਮੂਨ ਯਾਦ ਰਹੇ ਸੋ ਕਾਫੀ ਅੱਛੀ ਪਲੇਸ ਸੀ ਹੀਲ ਕਾਫੀ ਸਨੋਅ ਹੋਈ ਹੋਈ ਸੀ ਕਾਫੀ ਹੀਲਸ ਕਾਫੀ ਅੱਛਾ ਅੱਛੇ ਲੱਗ ਰਹੇ ਸੀ ਕਾਫੀ ਟੂਰਿਸਟ ਆਏ ਹੋਏ ਸੀ ਅਤੇ ਅਸੀਂ ਬਹੁਤ ਇੰਜੋਏ ਕੀਤਾ ਅਸੀਂ ਲੋਕਲ ਡਰੈਸਿਸ ਪਾਈ ਉੱਥੇ ਫੋਟੋਆਂ ਖਿੱਚੀਆਂ ਅਤੇ ਕਾਫੀ ਅੱਛਾ ਉੱਥੇ ਦੀ ਫੇਮਸ ਹੈ ਲੇਕ ਹੈ ਵੈਰੀ ਫੈਮਸ ਹੈ ਕਾਫੀ ਟੂਰਿਸਟ ਆਉਂਦੇ ਹੈ ਅੱਗੇ ਸ਼ਿਵਾਜੀ ਟੈਂਪਲ ਹੈ ਕਾਫੀ ਕਾਫੀ ਕਾਫੀ ਲੋਕ ਉੱਥੇ ਵੀ ਜਾਂਦੇ ਹੈ ਅਸੀਂ ਕਾਫੀ ਪਲੇਸ ਘੁੰਮੇ ਲੋਕਲ ਮਾਰਕਿਟ ਅਤੇ ਅਸੀਂ ਸ਼ੋਪਿੰਗ ਕੀਤੀ ਕਾਫੀ ਇੰਜੋਏ ਕੀਤਾ ਲੋਕਲ ਫੂਡ ਐਕਪਲੋਰ ਕੀਤਾ ਕਿਉਂਕਿ ਬਹੁਤ ਅੱਛਾ ਲੱਗਿਆ ਸਾਨੂੰ ਅਤੇ ਇੱਕ ਓਵਰਔਲ ਅੱਛਾ ਐਕਸਪੀਰੀਐਂਸ ਰਿਹਾ ਸਾਡਾ